ਮੈਂ ਸਵਿਗੀ ਤੋਂ ਪਹਿਲੀ ਵਾਰ ਖਾਣਾ ਔਡਰ ਕਰਿਆ ਮੈਂ ਇੱਕ ਪੀਜ਼ਾ ਦੋ ਬਰਗਰ ਦੋ ਕੋਕ ਔਡਰ ਕਰੇ ਮੇਰਾ ਔਡਰ ਪਲੇਸ ਹੋਣ ਤੋਂ ਬਾਅਦ ਮੈਨੂੰ ਔਡਰ ਤਿਆਰ ਹੋਣ ਦਾ ਸਮਾਂ ਅਤੇ ਡਿਲੀਵਰ ਹੋਣ ਦਾ ਸਮਾਂ ਐਪ 'ਤੇ ਦੱਸਿਆ ਜਾ ਰਿਹਾ ਸੀ ਉਸ ਅਨੁਸਾਰ ਮੇਰਾ ਔਡਰ ਤਿਆਰ ਹੋਣ ਵਿੱਚ ਵੀਹ ਮਿੰਟ ਅਤੇ ਡਿਲੀਵਰ ਹੋਣ ਵਿੱਚ ਦਸ ਮਿੰਟ ਸ ਦਾ ਸਮਾਂ ਸੀ ਕੁਲ ਮਿਲਾ ਕੇ ਐਪ 'ਤੇ ਇਕ ਘੰਟਾ ਅਤੇ ਤੀਹ ਮਿੰਟ ਦਾ ਸਮਾਂ ਦੱਸਿਆ ਜਾ ਰਿਹਾ ਸੀ ਅਤੇ ਇਸ ਨਾਲ ਮੈਨੂੰ ਡਿਲੀਵਰੀ ਬੋਏ ਦਾ ਨੰਬਰ ਅਤੇ ਡਿਲੀਵਰੀ ਬੋਏ ਦਾ ਨਾਮ ਅਤੇ ਜਿਸ ਰਸਤੇ 'ਤੇ ਉਸ ਨੇ ਮੇਰਾ ਔਡਰ ਲੈ ਕੇ ਆਉਣਾ ਸੀ ਉਹ ਰਸਤਾ ਵੀ ਦੱਸਿਆ ਜਾ ਰਿਹਾ ਸੀ ਮੈਂ ਡਿਲੀਵਰੀ ਬੋਏ ਨੂੰ ਫੋਨ ਕਰਕੇ ਪੁੱਛਿਆ ਕਿ ਐਪ 'ਤੇ ਦੱਸੇ ਜਾ ਰਹੇ ਸਮੇਂ ਅਨੁਸਾਰ ਮੇਰਾ ਔਡਰ ਪਹੁੰਚ ਜਾਵੇਗਾ ਤਾਂ ਉਸ ਨੇ ਮੈਨੂੰ ਕਿਹਾ ਕਿ ਉਹ ਮੇਰਾ ਔਡਰ ਸਮੇਂ ਸਿਰ ਪਹੁੰਚਾ ਦੇਵੇਗਾ ਅਤੇ ਜਦੋਂ ਉਹ ਮੇਰਾ ਔਡਰ ਲੈ ਕੇ ਚੱਲਿਆ ਤਾਂ ਮੈਨੂੰ ਉਸ ਦੀ ਲੋਕੇਸ਼ਨ ਐਪ 'ਤੇ ਦੱਸੀ ਜਾ ਰਹੀ ਸੀ ਉਹ ਔਡਰ ਲੈ ਕੇ ਮੇਰੇ ਘਰ ਦਸ ਮਿੰਟ ਪਹਿਲਾਂ ਹੀ ਆ ਗਿਆ ਇਸ ਨਾਲ ਮੈਂ ਬਹੁਤ ਖੁਸ਼ ਹੋਇਆ ਮੈਂ ਉਸ ਨੂੰ ਐਪ 'ਤੇ ਪੰਜ ਸਟਾਰ ਰੇਟਿੰਗ ਵੀ ਦਿੱਤੀ ਅਤੇ ਟਿਪ ਵੀ ਦਿੱਤੀ